ਗਾਇਕੀ ਸਮੇਂ ਥਕਾਵਟ ਜਾਂ ਗੂੜ੍ਹੇਪਨ ਦਾ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਦੇ ਹੋਏ ਠੀਕ ਰੱਖਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਰਾਗਾਂ ਨੂੰ ਨਿਯਮ ਬਣਾ ਕੇ ਸਮਾਂਬੱਧ ਹਰ ਰੋਜ਼ ਗਾਉਣਾ ਇਹ ਸਾਡੇ ਦਿਮਾਗ ਦੇ ਕੁਝ ਅਜਿਹੇ ਹਿੱਸਿਆਂ ਨੂੰ ਛੂੰਹਦੇ ਹਨ ਜਿਨ੍ਹਾਂ ਨਾਲ ਖੁਸ਼ ਰੱਖਣ ਵਾਲੇ ਹਾਰਮੋਨ ਨਿਕਲਦੇ ਹਨ ਗਾਉਂਦੇ ਹੋਏ ਆਵਾਜ਼ ਸਾਂਭਣ ਲਈ ਚੰਗਾ ਸਾਹ ਲੈਣ ਦਾ ਅਭਿਆਸ ਜ਼ਰੂਰੀ ਹੈ ਆਪਣੀ ਆਵਾਜ਼ ਨੂੰ ਛਾਤੀ ਤੋਂ ਗਹਿਰਾ ਸਾਹ ਲੈ ਕੇ ਸਹਾਰਾ ਦਿਓ ਕੁਝ ਅਜਿਹੀਆਂ ਕਸਰਤਾਂ ਵੀ ਹਨ ਜੋ ਕੇਵਲ ਗਲੇ ਨੂੰ ਸੌਖਾ ਰੱਖਣ ਲਈ ਹੁੰਦੀਆਂ ਹਨ ਯੋਗ ਵਿੱਚ ਵੀ ਤਾੜ ਆਸਣ ਐਸੇ ਲਈ ਹੀ ਹੁੰਦਾ ਹੈ ਅਵਾਜ਼ ਦੇ ਭਾਰੀਪਨ ਜਾਂ ਗਲੇ ਦੀ ਥਕਾਵਟ ਲਈ ਕੋਸਾ ਪਾਣੀ ਪੀਣਾ ਚਾਹ ਜਾਂ ਕੌਫ਼ੀ ਤੋਂ ਪਰਹੇਜ਼ ਰੱਖਣਾ ਬਿਨਾਂ ਮੈਂਥੋਲ ਅਤੇ ਬਿਨਾਂ ਯੂਪਲਿਪਟਸ ਦੇ ਪੇ ਪਦਾਰਥ ਪੀਣੇ ਗਰਮ ਭਾਫ਼ ਲੈਣਾ ਇਹ ਵੀ ਕਾਰਗਾਰ ਸਾਬਿਤ ਹੋ ਸਕਦੇ ਹਨ ਸ਼ਰਾਬ ਨੂੰ ਤਾਂ ਬਿਲਕੁਲ ਹੀ ਨਾਂਹ ਕਹਿਣਾ ਪਵੇਗਾ